ਹੈਲੋ ਹਾਂਜੀ ਵੀਰੇ ਕੀ ਹਾਲ ਹੈ ਬਾ ਵੀਰ ਹੈਲੋ ਹੈਲੋ ਮੈਨੂੰ ਵੀਰੇ ਇੱਕ ਦੱਸਿਓ ਮੈਂ ਨਾ ਮੋਦੀ ਕੋਲਜ ਪਟਿਆਲੇ ਦੇ ਵਿੱਚ ਐਡਮਿਸ਼ਨ ਲਿੱਤੀ ਹੈ ਅਤੇ ਉੱਥੇ ਮੈਨੂੰ ਪੀ ਜੀ ਚਾਹੀਦਾ ਹੈ ਕੋਈ ਤੁਹਾਡੀ ਨਿਗਾਹ 'ਚ ਮੋਦੀ ਮ ਲਿੱਤਾ ਐਡਮਿਸ਼ਨ ਮੋਦੀ ਕੋਲਜ 'ਚ ਮੈਨੂੰ ਜਿੱਥੇ ਮਰਜ਼ੀ ਪੀ ਜੀ ਲੀ ਜਾ ਮਿਲ ਜਾਵੇ ਮੈਂ ਆਪਣਾ ਵਹੀਕਲ ਲਵੇ ਰੱਖਿਆ ਹੋਇਆ ਇੱਕ ਠੀਕ ਹੈ ਜੀ ਕੋਠੀ ਦਾ ਕਿਰਾਇਆ ਕਿੰਨਾ ਹੈ ਜੀ ਪੂਰੀ ਕੋਠੀ ਦਾ ਵੀ ਕਿਰਾਇਆ ਦੱਸ ਦਿਓ ਪੀ ਜੀ ਦਾ ਵੀ ਰੇਟ ਦੱਸ ਦਿਓ ਅੱਛਾ ਠੀਕ ਹੈ ਓਕੇ

ਠੀਕ ਹੈ ਪਰ ਐਂਏ ਜੀ ਮੈਂ ਇਕੱਲਾ ਬੰਦਾ ਜੀ ਮੈਨੂੰ ਉਹਦੀ ਦਿੱਕਤ ਨਾ ਓਕੇ ਦਿੱਕਤ ਆਊਗੀ ਮੈਨੂੰ ਕਿਰਾਏ ਕੱਢਣ ਨੂੰ ਕਿਉਂਕਿ ਖਰਚਾ ਵੀ ਮੈਨੂੰ ਸਾਰਾ ਆਪ ਹੀ ਦੇਣਾ ਪੈਣਾ

ਅੱਛਾ ਅਤੇ ਉਸ 'ਤੇ ਕੋਈ ਓਬਜੈਕਸ਼ਨ ਤਾਂ ਨਹੀਂ ਹੋਊਗੀ ਮੈਂ ਕੋਈ ਵੀ ਕੁਛ ਵੀ ਕਰਾਂ ਚਲੋ ਇਹ ਕਿੱਥੇ ਕਿੱਥੇ ਇ ਏਕ ਇਹ ਕਿੱਥੇ ਐਡਰੈਸ ਹੈ ਇਹਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਹੋਰ ਕਿਸੀ ਜੇ ਹੋ ਸਕੇ ਮੋਦੀ ਕੋਲਜ ਦੇ ਨੇੜੇ ਜਾਂ ਫਿਰ ਕਿਤੇ ਹੋਰ ਹੋਵੇ ਬਾਈ ਨੰਬਰ ਨੂੰ ਛੱਡ ਕੇ ਹਾਂਜੀ ਹਾਂਜੀ ਠੀਕ ਹੈ ਉਹ ਕਿੰਨੇ ਕੁ ਦੀ ਰੇਂਜ ਦਾ ਓਕੇ ਠੀਕ ਹੈ ਜੀ ਠੀਕ ਹੈ ਉਹਦੇ ਵਿੱਚ ਕੀ ਆਪਾਂ ਨੂੰ ਬਿਜਲੀ ਬਿੱਲ ਬਿਜ ਬਿਜਲੀ ਦਾ ਬਿੱਲ ਅੱਡ ਦੇਣਾ ਪੈਣਾ ਅੱਛਾ ਜੀ ਅੱਛਾ ਜੀ ਆਪਾਂ ਇਹ ਤਾਂ ਨਹੀਂ ਕਰ ਸਕਦੇ ਦੱਸਣਾ ਥੋੜੇ ਆ ਕਿ ਆਪਾਂ ਮੋਦੀ ਕੋਲਜ ਦੇ ਸਟੂਡੈਂਟ ਆ ਆਪਾਂ ਤਾਂ ਕਹਿ ਐਂ ਵੀ ਕਹਿ ਸਕਦੇ ਕਿ ਯਾਰ ਭਾਅ ਜੀ ਥਾਪਰ ਦੇ ਪੜ੍ਹਨ ਵਾਲੇ ਹਾਂ ਸਾਨੂੰ ਥੋੜ੍ਹਾ ਲੈਸ ਕਰਕੇ ਲਾ ਦਿਓ ਸਾਨੂੰ ਥੋੜ੍ਹਾ ਦੂਰ ਪਊਗਾ ਕਿਉਂਕਿ ਇਹ ਬ ਜ਼ਿਆਦਾ ਕਿਉਂਕਿ ਆਪਣੇ ਵਰਗੇ ਬੰਦੇ ਲਈ ਕੱਢਣਾ ਕਿਰਾਇਆ ਬੜਾ ਔਖਾ ਹੈ ਜੀ

ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਆ ਕੇ ਫਿਰ ਪਟਿਆਲੇ ਆ ਕੇ ਫੋਨ ਕਰਦਾ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਓਕੇ ਜੀ